ਜੇਕਰ ਰੋਜ਼ਾਨਾ ਜੀਵਨ ਵਿੱਚ ਸਭ ਤੋਂ ਵਧੀਆ ਵਿੱਤੀ ਸਾਧਨਾਂ ਦੀ ਗੱਲ ਕਰੀਏ ਤਾਂ ਕੁਝ ਚੀਜ਼ਾਂ ਬਹੁਤ ਮਦਦਗਾਰ ਹੁੰਦੀਆਂ ਹਨ ਬਜਟਿੰਗ ਲਈ ਵਧੀਆ ਐਪਸ ਹੁੰਦੀਆਂ ਹਨ ਜਿਵੇਂ ਮਿੰਟ ਆਟੋਮੈਟਿਕ ਬਜਟਿੰਗ ਅਤੇ ਖਰਚਾ ਦਾ ਟੈਕਸਿੰਗ ਜਿਵੇਂ ਪੋਕਿਟ ਗਾਰਡ ਇਹ ਦੱਸਦਾ ਹੈ ਕਿ ਤੁਸੀਂ ਕਿੰਨਾ ਖਰਚ ਕਰ ਸਕਦੇ ਹੋ ਬਿਨਾ ਫੀਸ ਵਾਲੇ ਬੈਂਕ ਖਾਤੇ ਕਈ ਬੈਂਕ ਫੀਸ ਮੁਕਤ ਚੈਕਿੰਗ ਅਕਾਊਂਟ ਦੀ ਸੇਵਾ ਦਿੰਦੇ ਹਨ ਜੋ ਕਿ ਫੈਸਲੇ ਮਨ ਅਤੇ ਲੰਬੇ ਸਮੇਂ ਲਈ ਵਧੀਆ ਹੋਣ ਵਧੀਆ ਚੋਣ ਹੁੰਦੀ ਹੈ ਜਿਵੇਂ ਕੁਛ ਐਪਸ ਹਨ ਜਿਵੇਂ ਚਾਈਮ ਕੋਈ ਓਵਰਡਰਾਫਟ ਫੀਸ ਨਹੀਂ ਆਟੋਸੇਵਿੰਗ ਆਪਸ਼ਨ ਹੁੰਦੀ ਹੈ ਇਹਦੇ 'ਚ ਐਲੀ ਬੈਂਕ ਹਾਈ ਇੰਟਰਨੈਟ ਚੈਕਿੰਗ ਅਤੇ ਕੋਈ ਮਿਨੀਮਮ ਬੈਲੈਂਸ ਦੀ ਲੋੜ ਨਹੀਂ ਹੁੰਦੀ ਇਹਦੇ 'ਚ ਡਿਸਕਵਰ ਬੈਂਕ ਸੌ ਪ੍ਰਸੈਂਟ ਫਰੀ ਫੀਸ ਚੈਕਿੰਗ ਹੁੰਦੀ ਹੈ ਇਹਦੇ 'ਚ ਵਿਅਕਤੀਗਤ ਨਿਵੇਸ਼ ਅਤੇ ਬਚਤ ਜਿਵੇਂ ਅਕਾਉਂਡ ਨਾਨਕਾ ਨਾਨਕਾ ਨਿਵੇਸ਼ ਕਰਕੇ ਭਵਿੱਖ ਲਈ ਬਚਤ ਜਿਵੇਂ ਰੋਬਿਨਹੁੱਡ ਫਰੀ ਡਰੈਟਿੰਗ ਐਪ ਜੋ ਨਵੇਂ ਨਿ ਨਿਵੇਸ਼ਕਾਂ ਲਈ ਵਧੀਆ ਹਨ ਜਿਵੇਂ ਫਾਈਡਲਿਟੀ ਡਿਗਰੀ ਰਿਟਾਇਰਮੈਂਟ ਅਤੇ ਲੰਬੀ ਮਿਆਦ ਲਈ ਪਲੇਨ ਪਲੈਨਿੰਗ ਕਰ ਸਕਦੇ ਹਨ ਇਹਦੇ 'ਚ ਆਪਾਂ ਫਰੀ ਕ੍ਰੈਡਿਟ ਸਕੋਰ ਮੋਨੀਟਰਿੰਗ ਐਪ ਜਿਹਦੀ ਕ੍ਰੈਡਿਟ ਸਕੋਲ ਟਰੈਕ ਕਰਨ ਲਈ ਆਪਾਂ ਕੀ ਕਰ ਸਕਦੇ ਹਨ ਜਿਵੇਂ ਕ੍ਰੈਡਿਟ ਕਾਰਮਾ ਮੁਫਤ ਕ੍ਰੈਡਿਟ ਸਕੋਲ ਅਤੇ ਪਸੰਦੀਦਾ ਕਾਰਡ ਦੀ ਰਿ ਰਿਕਮੈਂਡੇਸ਼ਨ ਕਰ ਸਕਦੀ ਹਨ ਇਹਦੇ 'ਚ